ਹ ਹੈਲੋ ਹਾਂਜੀ ਨਮਸਕਾਰ ਹਾਂਜੀ ਬੋਲ ਰਿਹਾਂ ਜੀ ਓਕੇ ਸਰ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਸਰ ਮੈਂ ਕੋਈ ਨਹੀਂ ਤੁਸੀਂ ਦੱਸ ਦਿਓ ਕਿੱਦਾਂ ਕਰਨੀ ਮੈਂ ਉਹਨਾਂ ਨੂੰ ਅਲਾਓ ਕਰ ਦੂੰਗਾ ਹਾਂਜੀ ਠੀਕ ਆ ਸਰ ਕੋਈ ਨਹੀਂ ਤੁਸੀਂ ਭੇਜ ਦੇਣਾ ਮੈਂ ਮਤਲਬ ਕਰ ਦੂੰਗਾ ਅਲਾਓ ਓਕੇ ਸਰ